ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਬੈਂਕਾਂ ਖੁੱਲ੍ਹੀਆਂ ਹੋਈਆਂ ਹਨ ਜਿਸ ਵਿੱਚ ਅਸੀਂ ਪੈਸਾ ਜਮ੍ਹਾਂ ਅਤੇ ਕੱਢਵਾ ਸਕਦੇ ਹਾਂ ਬਜ਼ੁਰਗ ਲੋਕਾਂ ਦੀਆਂ ਪੈਨਸ਼ਨਾਂ ਇਹਨਾਂ ਬੈਂਕਾਂ ਵਿੱਚ ਆਉਂਦੀਆਂ ਹਨ ਇਹਨਾਂ ਬੈਂਕਾਂ ਵਿੱਚੋਂ ਲੋਨ ਅਤੇ ਬੀਮੇ ਦੀਆਂ ਸੁਵਿਧਾਵਾਂ ਹਨ ਜਿਹੜੇ ਅਸੀਂ ਬੀਮੇ ਕਰਵਾਉਂਦੇ ਹਾਂ ਅਸੀਂ ਉਹਨਾਂ ਦਾ ਕੁਝ ਹਿੱਸਾ ਭੁਗਤਾਨ ਕੀਤਾ ਜਾਂਦਾ ਹੈ ਜਦੋਂ ਕਿਸੇ ਦਾ ਐਕਸੀਡੈਂਟ ਹੋ ਜਾਵੇ ਜਾਂ ਕੋਈ ਹੋਰ ਬਿਮਾਰੀ ਦਾ ਇਲਾਜ ਕਰਵਾਉਣਾ ਹੋਵੇ ਤਾਂ ਬੀਮੇ ਦੀ ਵਰਤੋਂ ਕੀਤੀ ਜਾਂਦੀ ਹੈ ਸਰਕਾਰ ਵੱਲੋਂ ਇਹ ਯੋਜਨਾਵਾਂ ਦਿੱਤੀਆਂ ਜਾਂਦੀਆਂ ਹਨ ਹਸਪਤਾਲਾਂ ਵਿੱਚ ਬੀਮੇ ਦੀ ਪ੍ਰਕਿਰਿਆ ਹਸਪਤਾਲ ਦੇ ਕਰਮਚਾਰੀ ਹੀ ਰਾਹੀਂ ਪ੍ਰਬੰਧ ਕੀਤਾ ਜਾਂਦਾ ਹੈ ਕੋਈ ਨਿਰਵਿਘਨ ਹੋ ਜਾਵੇ ਤਾਂ ਸਰਕਾਰ ਵੱਲੋਂ ਪਰਿਵਾਰ ਨੂੰ ਨਿਯਮਤ ਰਾਸ਼ੀ ਦਿੱਤੀ ਜਾਂਦੀ ਹੈ ਜਿਸ ਨਾਲ ਉਹਨਾਂ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਜਾਂਦੀ ਹੈ ਪਰ ਇਹ ਵਿੱਤੀ ਸਹਾਇਤਾ ਸਾਨੂੰ ਲੈਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ